ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਨੂੰ ਬਾਈਕਾਂ ਦਾ ਬਹੁਤ ਸ਼ੌਂਕ ਹੈ ਮੈਂ ਵੱਖ ਵੱਖ ਤਰ੍ਹਾਂ ਦੀ ਬਾਈਕਾਂ ਰੱਖੀਆਂ ਹੋਈਆਂ ਹਨ ਅਤੇ ਮੈਂ ਕਈ ਜਗ੍ਹਾ 'ਤੇ ਘੁੰਮਣ ਜਾਂਦਾ ਹਾਂ ਤਾਂ ਬਾਈਕਾਂ 'ਤੇ ਹੀ ਜਾਂਦਾ ਹਾਂ ਮੇਰੇ ਦੋਸਤ ਅਤੇ ਮੈਂ ਹਮੇਸ਼ਾਂ ਕਿਤੇ ਨਾ ਕਿਤੇ ਘੁੰਮਣ ਜਾਂਦੇ ਰਹਿੰਦੇ ਹਾਂ ਅਤੇ ਅਕਸਰ ਬਾਈਕ 'ਤੇ ਹੀ ਜਾਂਦੇ ਹਾਂ ਕਿਉਂਕਿ ਬਾਈਕ 'ਤੇ ਜਾਣ ਨਾਲ ਇੱਕ ਤਾਂ ਪੈਟਰੋਲ ਦਾ ਖਰਚਾ ਘੱਟ ਹੁੰਦਾ ਹੈ ਅਤੇ ਖੁੱਲ੍ਹੇ ਵਾਤਾਵਰਨ ਬਾਰੇ ਵੀ ਪਤਾ ਲੱਗਦਾ ਹੈ ਅਸੀਂ ਆਪਣੇ ਵਾਤਾਵਰਨ ਨਾਲ ਜੁੜ ਕੇ ਰਹਿੰਦੇ ਹਾਂ ਇੱਕ ਤਾਂ ਬਾਈਕਾਂ ਦਾ ਫਾਇਦਾ ਇਹ ਹੈ ਕਿ ਤੰਗ ਰਸਤਿਆਂ ਵਿੱਚ ਵੀ ਅਸੀਂ ਆਰਾਮ ਨਾਲ ਜਾ ਸਕਦੇ ਹਾਂ ਅਤੇ ਬਾ ਬਾਈਕਾਂ 'ਤੇ ਅਸੀਂ ਕਈ ਕਈ ਜਗ੍ਹਾ ਜਿੱਦਾਂ ਜਲ ਜਲ੍ਹਿਆਂ ਆਲੇ ਬਾਗ ਪਹਾੜਾਂ ਵਿੱਚ ਕਈ ਜਗ੍ਹਾ ਘੁੰਮਣ ਜਾਂਦੇ ਰਹਿੰਦੇ ਹਾਂ ਸਾਨੂੰ ਹਮੇਸ਼ਾਂ ਬਾਈਕ ਸੇਫਟੀ ਨਾਲ ਚਲਾਉਣੀ ਚਾਹੀਦੀ ਹਨ ਅਤੇ ਰੂਲ ਫੋਲੋ ਕਰਨੇ ਚਾਹੀਦੇ ਹਨ ਜਿਵੇਂ ਕਿ ਹੈਲਮੇਟ ਪਾ ਕੇ ਹੀ ਬਾਈਕ ਚਲਾਉਣੀ ਚਾਹੀਦੀ ਹੈ ਅਤੇ ਹਮੇਸ਼ਾਂ ਲਾਈਟਾਂ ਸਿਗਨਲ ਦੀਆਂ ਵਰਤੋਂ ਮਤਲਬ ਕਿ ਜਾ ਜਾਣਕਾਰੀ ਰੱਖਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਅਤੇ ਅਸੀਂ ਕਈ ਸੱਭਿਆਚਾਰਕ ਜਗ੍ਹਾ 'ਤੇ ਵੀ ਜਾਂਦੇ ਰਹਿੰਦੇ ਹਾਂ ਸੱਭਿਆਚਾਰ ਇਸ ਇਸ ਨਾਲ ਸਾਨੂੰ ਸੱਭਿਆਚਾਰ ਦਾ ਵੀ ਪਤਾ ਲੱਗਦਾ ਹੈ ਅਤੇ ਨਵੀਂ ਨਵੀਂ ਜਗ੍ਹਾ ਵੀ ਘੁੰਮ ਲੈਂਦੇ ਹਾਂ ਮੈਂ ਅਤੇ ਮੇਰਾ ਦੋਸਤ ਹਮੇਸ਼ਾਂ ਬਾਈਕਾਂ 'ਤੇ ਹੀ ਘੁੰਮਦੇ ਹਾਂ ਅਤੇ ਮੌਜ ਮਸਤੀ ਕਰਦੇ ਹਾਂ ਚਲੋ ਜੀ